ਦੇਖੋ ਜੀ ਦੇਖੋ ਜੀ ਖੇਡਾਂ ਜਿਹੜੀਆਂ ਹੈਗੀਆਂ ਸਾਡੇ ਸਰੀਰ ਨੂੰ ਸਿਹਤਮੰਦ ਬਣਾਉਂਦੀਆਂ ਆਪਾਂ ਕੋਈ ਵੀ ਖੇਡ ਖੇਡੀਏ ਚਾਹੇ ਕਬੱਡੀ ਆ ਚਾਹੇ ਦੌੜ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾ ਲਈਏ ਬਾਸਕਿਟਬੋਲ ਆ ਕੁਛ ਵੀ ਆ ਕੁਛ ਨਾ ਕੁਛ ਇਹੋ ਜਿਹੀ ਆਪਾਂ ਨੂੰ ਗੇਮ ਕ ਖੇਡ ਖੇਡਣੀ ਚਾਹੀਦੀ ਆ ਜਿਹਦੇ ਨਾਲ ਕਿ ਬੰਦੇ ਦਾ ਸਰੀਰ ਤੰਦਰੁਸਤ ਰਹਿੰਦਾ ਵਾ ਇੱਕ ਤਾਂ ਨਸ਼ਿਆਂ ਤੋਂ ਬੰਦਾ ਦੂਰ ਰਹੇਗਾ ਜਿਹੜਾ ਬੰਦਾ ਖੇਡਾਂ ਜਿਹਦਾ ਧਿਆਨ ਰੁਝਾਨ ਰਹੇਗਾ ਉਹ ਨਸ਼ਿਆਂ ਤੋਂ ਦੂਰ ਰਹੇਗਾ ਨਸ਼ਿਆਂ ਤੋਂ ਰਹਿਤ ਰਹੇਗਾ ਅਤੇ ਇੱਕ ਉਹਦੀ ਸੰਗਤ ਵਧੀਆ ਹੋਏਗੀ ਮਾੜੀ ਸੰਗਤ 'ਚ ਉਹ ਨਹੀਂ ਬੰਦਾ ਬੈਠੇਗਾ ਸਿਹਤ ਦੇਖੋ ਜਦੋਂ ਜਿੰਨੇ ਖੇਡ ਖੇਡਣੀ ਹੈ ਕਿਸੇ ਵੀ ਤਰ੍ਹਾਂ ਦੀ ਉਹਨੇ ਖੁਰਾਕ ਵਧੀਆ ਖਾਣੀ ਆ ਮਾੜੀ ਚੀਜ਼ ਉਹਨੇ ਨਹੀਂ ਖਾਣੀ ਆ ਨ ਨੂਡਲ ਮੋਮੋਜ਼ ਕੁਰਕਰੇ ਵਗੈਰਾ ਇਹੋ ਜਿਹਾ ਕੁਛ ਉਹਨੇ ਖਾਣਾ ਨਹੀਂ ਆ ਉਹਨੇ ਸਾਰੀਆਂ ਵਧੀਆ ਫ ਫਲ ਫਰੂਟ ਦਹੀਂ ਪਨੀਰ ਦੁੱਧ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਅਤੇ ਜਦੋਂ ਇਹੋ ਜਿਹੀਆਂ ਪਿਓਰ ਚੀਜ਼ਾਂ ਖਾਣੀਆਂ ਅਤੇ ਬੰਦਾ ਕਿੱਦਾਂ ਉਹਨੂੰ ਕਿੱਦਾਂ ਕੋਈ ਰੋਗ ਲੱਗ ਜਾਏਗਾ ਹੈ ਨਾ ਇਸ ਕਰਕੇ ਸਿਹਤ ਤਾਂ ਸਭ ਸਿਹਤ ਜੇ ਤੁਸੀਂ ਆਪਣੀ ਸਿਹਤ ਵਾਸਤੇ ਵੇਖਦੇ ਹੋ ਨਾ ਅਤੇ ਕੋਈ ਨਾ ਕੋਈ ਤੁਹਾਨੂੰ ਖੇਡ ਦੇ ਵਿੱਚ ਯੋਗਦਾਨ ਤੁਹਾਡਾ ਹੋਣਾ ਚਾਹੀਦਾ ਹਿੱਸੇਦਾਰੀ ਹੋਣੀ ਚਾਹੀਦੀ ਹੈ ਖੇਡਣ ਦੇ ਵਿੱਚ ਕਿਉਂਕਿ ਪੜ੍ਹਾਈ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਬਹੁਤ ਜਰੂਰੀ ਆ ਇੱਕ ਤਾਂ ਬੰ ਦਿਮਾਗ ਦਿਮਾਗੀ ਤੌਰ 'ਤੇ ਬੱਚਿਆਂ ਨੂੰ ਠੀਕ ਰੱਖਦੀ ਹੈ ਖੇਡਾਂ ਇੱਕ ਸਰੀਰਿਕ ਪੱਖੋਂ ਵਧੀਆ ਰਹਿੰਦਾ ਸਰੀਰ ਖੇਡਾਂ ਦੇ ਹਿਸਾਬ ਦੇ ਨਾਲ ਧੰਨਵਾਦ ਜੀ